ਹੈਲੋ ਤੁਸੀਂ ਸਵਿਗੀ ਤੋਂ ਬੋਲ ਰਹੇ ਹੋ ਜੀ ਅੱਜ ਅਸੀਂ ਕੁਝ ਜਣਿਆ ਦਾ ਖਾਣਾ ਓਰਡਰ ਕਰਨਾ ਚਾਹੁੰਦੇ ਸੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਡੇ ਰੈਸਟੋ ਵਿੱਚ ਅੱਜ ਕੀ ਕੁਛ ਬਣਿਆ ਹੋਇਆ ਕੁਛ ਸਪੈਸ਼ਲ ਬਣਿਆ ਹੋਇਆ ਜੋ ਵੀ ਮੈਂ ਵੀਹ ਤੋਂ ਪੱਚੀ ਲੋਕਾਂ ਦਾ ਖਾਣਾ ਮੰਗਵਾਉਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਘਰ ਇੱਕ ਅੱਜ ਛੋਟੀ ਜਿਹੀ ਪਾਰਟੀ ਹੈ ਔਰ ਮੈਨੂੰ ਖਾਣਾ ਫਰੈਸ਼ ਚਾਹੀਦਾ ਹੈ ਜੋ ਕਿ ਮੇਰੇ ਮਹਿਮਾਨਾਂ ਨੂੰ ਪਸੰਦ ਆ ਸਕੇ ਔਰ ਇੱਕ ਮੈਨੂੰ ਇਹ ਖਾਣਾ ਬਿਲਕੁਲ ਟਾਈਮ 'ਤੇ ਚਾਹੀਦਾ ਹੈ ਕਿਉਂਕਿ ਪਹਿਲਾਂ ਆਏਗਾ ਤਾਂ ਠੰਡਾ ਵਗੈਰਾ ਹੋ ਜਾਵੇਗਾ ਇਸ ਲਈ ਫਰੈਸ਼ ਔਰ ਟਾਈਮ 'ਤੇ ਜ਼ਰੂਰੀ ਹੈ ਖਾਣਾ ਔਰ ਅੱਜ ਦੇ ਦਿਨ ਕੀ ਕੋਈ ਤੁਸੀਂ ਮਤਲਬ ਮੈਂ ਇੰਨੇ ਜਣਿਆਂ ਦਾ ਖਾਣਾ ਮੰਗਵਾ ਰਹੀ ਹਾਂ ਉਸ 'ਤੇ ਮੈਨੂੰ ਕੋਈ ਡਿਸਕਾਊਂਟ ਵਗੈਰਾ ਵੀ ਦਿਉਂਗੇ ਜਾਂ ਇੱਕ ਦੋ ਵਾਰ ਪਹਿਲਾਂ ਵੀ ਅਸੀਂ ਤੁਹਾਡੇ ਇੱਥੋਂ ਖਾਣਾ ਔਡਰ ਕਰਿਆ ਹੈ ਅਤੇ ਉਸ 'ਤੇ ਕੋਈ ਕੂਪਨ ਵਗੈਰਾ ਮੇਰੇ ਕੋਲ ਪਏ ਨੇ ਕੀ ਉਹ ਵੀ ਅੱਜ ਚੱਲ ਸਕਦੇ ਆ ਜੇ ਮੈਂ ਚਲਾਉਣਾ ਚਾਹਵਾਂ ਉਹਨਾਂ ਨੂੰ ਅਤੇ ਵੀਹ ਤੋਂ ਪੱਚੀ ਲੋਕਾਂ ਦਾ ਖਾਣਾ ਮੈਨੂੰ ਟਾਈਮ 'ਤੇ ਤੁਹਾਨੂੰ ਪਹੁੰਚਾਉਣਾ ਪਏਗਾ ਤਾਂ ਕਿ ਮੇਰੇ ਫੰਕਸ਼ਨ ਵਿੱਚ ਮੈਨੂੰ ਕੋਈ ਪ੍ਰੋਬਲਮ ਨਾ ਆਵੇ